ਚਾਰ ਲੱਖ ਪੱਚੀ ਹਜ਼ਾਰ ਛੇ ਸੌ ਪੈਂਹਠ ਪੰਜ ਲੱਖ ਅਠਾਰਾਂ ਹਜ਼ਾਰ ਸੱਤ ਸੌ ਵੀਹ ਤਿੰਨ ਲੱਖ ਪੰਤਾਲੀ ਹਜ਼ਾਰ ਦੋ ਸੌ ਅਠਾਸੀ ਦੋ ਲੱਖ ਤੀਹ ਹਜ਼ਾਰ ਚਾਰ ਸੌ ਬਿਆਲੀ ਸੱਤ ਲੱਖ ਅੱਠ ਹਜ਼ਾਰ ਦੋ ਸੌ ਛਿਆਸੀ